ਭੰਗੜਾ ਇਕ ਪ੍ਰਸਿੱਧ ਪੰਜਾਬੀ ਲੋਕ ਨਾਚ ਹੈ ਇਹ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੈ ਭੰਗੜਾ ਪੰਜਾਬ ਦੇ ਦੋ ਪ੍ਰਸਿੱਧ ਪ੍ਰਮੁੱਖ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਪ੍ਰਮੁੱਖ ਨਾਚ ਗਿੱਧਾ ਹੈ ਆਮ ਤੌਰ 'ਤੇ ਭੰਗੜਾ ਨੌਜਵਾਨ ਮੁੰਡੇ ਗੱਭਰੂ ਕਰਦੇ ਹਨ ਅਤੇ ਗਿੱਧਾ ਮੁਟਿਆਰਾਂ ਜਾਂ ਕੁੜੀਆਂ ਪਾਉਂਦੀਆਂ ਹਨ ਭੰਗੜਾ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਜਿਵੇਂ ਕਿ ਮੇਲੇ ਤਿਉਹਾਰਾਂ ਵਿਆਹ ਅਤੇ ਕਣਕ ਦੀ ਵਾਢੀ ਦੇ ਸਮੇਂ ਭਾਵ ਵਿਸਾਖੀ ਵਾਲੇ ਸਮੇਂ ਪਾਇਆ ਜਾਂਦਾ ਹੈ ਇਹ ਲੋਕ ਨਾਚ ਪਛ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਵਾਂਗ ਹੀ ਪ੍ਰਾਚੀਨ ਹੈ ਭੰਗੜੇ ਨੂੰ ਅਕਰਸ਼ਕ ਦਿਖਾਉਣ ਲਈ ਅਕਰਸ਼ਕ ਪੌਸ਼ਾਕਾਂ ਪਹਿਨੀਆਂ ਜਾਂਦੀਆਂ ਹਨ ਤਾਂ ਜੋ ਕਿ ਦੇਖਣ ਵਾਲੇ ਨੂੰ ਵਧੀਆ ਅਤੇ ਆਕਰਸ਼ਕ ਲੱਗੇ ਭੰਗੜੇ ਨੂੰ ਆਕਰਸ਼ਕ ਵਿਖਾਉਣ ਲਈ ਨੌਜਵਾਨ ਤੁਰਲੇ ਵਾਲੀ ਪੱਗ ਕੁੜਤਾ ਚਾਦਰਾ ਖੁੰਡਮੀ ਜੁੱਤੀ ਅਤੇ ਕੈਂਠਾ ਆਦਿ ਪਹਿਨਦੇ ਹਨ ਤਾਂ ਜੋ ਵੇਖਣ ਵਾਲੇ ਵਿਅਕਤੀ ਨੂੰ ਵਧੀਆ ਅਤੇ ਆਕਰਸ਼ਕ ਲੱਗ ਸਕੇ